ਇਹ ਬਿਲਕੁਲ ਸਹੀ ਹੈ ਪੰਜਾਬ ਵਿੱਚ ਇਹਨਾਂ ਪ੍ਰਮੁੱਖ ਟੈਕਨੋਲੋਜੀ ਐਡਵਾਂਟੇਜ ਅਤੇ ਕਨਫਰਮਾਂ ਦੀ ਮਦਦ ਨਾਲ ਉਮੀਦਾਂ ਨਿਵੇਸ਼ਕਾ ਅਤੇ ਟੈਕਨੋਲਜੀ ਪੇਸ਼ਾਵਰਾਂ ਨੂੰ ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਦੀ ਨਵੀਂ ਸਿੱਖਿਆ ਪ੍ਰਾਪਤ ਕਰਨੀ ਅਤੇ ਨਵੇਂ ਮੌਕਿਆਂ ਨੂੰ ਲੱਭਣ ਦੀ ਬਹੁਤ ਵਧੀਆ ਮੌਕਾ ਮਿਲਦਾ ਹੈ ਜਿਵੇਂ ਕਿ ਐਖਾਥੋਨ ਪੰਜਾਬ ਇਹ ਟੈਕਨੋਲੋਜੀ ਪੇਸ਼ਾਵਰਾਂ ਅਤੇ ਵਿਦਿਆਰਥੀਆਂ ਲਈ ਇੱਕ ਵੱਡਾ ਅਕਾਥ ਹੈ ਜੋ ਨਵੇਂ ਸਮਾਧਨਾਂ ਨੂੰ ਸਿਫਾਰਿਸ਼ਾਂ ਦੇ ਵਿਕਾਸ ਕਰਨ ਵਾਲੇ ਟੀਮਾਂ ਨੂੰ ਮਿਲ ਕੇ ਕੰਮ ਕਰਨ ਦਾ ਮੌਕਾ ਦਿੰਦੀ ਹੈ ਪੰਜਾਬ ਡਿਜੀਟਲ ਸਬਮਿਟ ਇਹ ਸੱਭਿਆਚਾਰ ਸਿੱਖਿਆ ਅਤੇ ਉਦਯੋਗ ਵਿੱਚ ਡਿਜੀਟਲ ਟਰਾਂਸਫਰਮ 'ਤੇ ਵਿਚਾਰ ਵਟਾਂ ਬਟਵਾਰਿਆਂ ਲਈ ਇੱਕ ਬਹੁਤ ਮਾਰਚ ਮੰਚ ਹੈ ਇੱਥੇ ਸਰਕਾਰਾਂ ਇੰਡਸਟਰੀ ਲੀਡਰਸ ਅਤੇ ਤਜ਼ਰਬੇਕਰ ਵਿਦਿਆਰਥੀਆਂ ਨੂੰ ਮਿਲ ਕੇ ਨਵਾਂ ਡਿਜੀਟਲ ਹਾਲ ਅਤੇ ਬਣਾਉਣ ਦੇ ਮੌਕਾ ਮਿਲਦਾ ਹੈ ਪੰਜਾਬ ਟੈਕਨੋਲੋਜੀ ਏਕਸਪੋ ਇਹ ਇਵੈਂਟ ਪੰਜਾਬ ਵਿੱਚ ਹੋਣ ਵਾਲੇ ਸਭ ਤੋਂ ਵੱਡੇ ਟੈਕਨੋਲੋਜੀ ਇਵੈਂਟ ਵਿੱਚੋਂ ਇੱਕ ਹੈ ਜਿਸ ਵਿੱਚ ਲੀਡਰਾਂ ਵਿੱਚ ਨਵੇਂ ਵਿਕਸਿਅਤ ਉਪਕਰਣ ਅਤੇ ਟੈਕਨੋਲਜੀ ਨੂੰ ਪ੍ਰਦਰਸ਼ਿਤ ਕੀਤੀ ਜਾਂਦੀ ਹਨ ਇਹ ਐਡ